ਭਾਰਤ ਵਿੱਚ ਮੌਸਮ ਬਹੁਤ ਹੀ ਸੁਹਾਵਣਾ ਹੁੰਦਾ ਹੈ ਇੱਥੇ ਹਰ ਰੁੱਤ ਆਉਂਦੀ ਹੈ ਗਰਮੀ ਸਰਦੀ ਪਤਝੜ ਹਰ ਮੌਸਮ ਇੱਥੇ ਆਉਂਦਾ ਹੈ ਅਤੇ ਖੁਸ਼ੀਆਂ ਹਰ ਮੌਸਮ ਆਪਣੇ ਨਾਲ ਆਪਣੇ ਨਾਲ ਦੇ ਢੰਗ ਲੈ ਕੇ ਆਉਂਦਾ ਹੈ ਜਦੋਂ ਸਰਦੀ ਵਿੱਚ ਥੋੜ੍ਹਾ ਜਿਹਾ ਸੁਸਤੀ ਛਾ ਜਾਂਦੀ ਹੈ ਕਾਫ਼ੀ ਜ਼ਿਆਦਾ ਜਦੋਂ ਸੁਸਤੀ ਹੋ ਜਾਂਦੀ ਹੈ ਰਜਾਈਆਂ ਚੋਂ ਬਾਹਰ ਨਿਕਲਣ ਨੂੰ ਦਿਲ ਨਹੀਂ ਕਰਦਾ ਫਿਰ ਮੌਸਮ ਆਉਂਦਾ ਹੈ ਸਪਰਿੰਗ ਸੀਜ਼ਨ ਜਿਸ ਨੂੰ ਆਪਾਂ ਕਹਿੰਦੇ ਹਾਂ ਅਤੇ ਉਹ ਮੌਸਮ ਫਿਰ ਕਾਫ਼ੀ ਜ਼ਿਆਦਾ ਖੁਸ਼ੀਆਂ ਲੈ ਕੇ ਆਉਂਦਾ ਆਪਣੇ ਨਾਲ ਅਤੇ ਨਾਲ ਫਿਰ ਗਰਮੀ ਚੜ੍ਹਦੀ ਗਰਮੀ ਆਉਂਦੀ ਹੈ ਬਰਸਾਤ ਪੈਂਦੀ ਹੈ ਉਸ ਤਰ੍ਹਾਂ ਫਿਰ ਗਰਮੀ ਦਾ ਮੌਸਮ ਸ਼ੁਰੂ ਹੁੰਦਾ ਉਸ ਦੇ ਨਾਲ ਕਾਫ਼ੀ ਜ਼ਿਆਦਾ ਖੁਸ਼ੀਆਂ ਖੇੜੇ ਤਿਉਹਾਰ ਹਰ ਚੀਜ਼ ਨੂੰ ਆਪਣੇ ਨਾਲ ਸੱਦਾ ਲੈ ਕੇ ਆਉਂਦਾ ਅਤੇ ਇਹ ਮਤਲਬ ਦੇਸ਼ ਦੇ ਜਿਹੜੇ ਵੱਖ ਵੱਖ ਖੇਤਰਾਂ ਵਿੱਚ ਵਰਖਾ ਆਪਣੇ ਆਪਣੇ ਹਿਸਾਬ ਨਾਲ ਹੁੰਦੀ ਹੈ ਜਿਵੇਂ ਪਹਾੜੀ ਇਲਾਕੇ ਵੱਲ ਵਰਖਾ ਜ਼ਿਆਦਾ ਹੋ ਜਾਂਦੀ ਹੈ ਅਤੇ ਜਿਹੜਾ ਇਲਾਕਾ ਪਹਾੜੀ ਨਹੀਂ ਹੁੰਦਾ ਉਸ ਦੇ ਵਿੱਚ ਵਰਖਾ ਘੱਟ ਹੁੰਦੀ ਹੈ ਮੈਂ ਪਟਿਆਲੇ ਦੀ ਰਹਿਣ ਵਾਲੀ ਹਾਂ ਤਾਂ ਮੈਂ ਪਟਿਆਲੇ ਦੇ ਮੌਸਮ ਬਾਰੇ ਦੱਸਾਂਗੀ ਇੱਥੇ ਦਾ ਮੌਸਮ ਇਸ ਸਮੇਂ ਬਹੁਤ ਜ਼ਿਆਦਾ ਵਧੀਆ ਚੱਲ ਰਿਹਾ ਹੈ ਸਰਦੀਆਂ ਤੋਂ ਬਾਅਦ ਵਾਲੀ ਧੁੱਪ ਨਿਕਲੀ ਹੋਈ ਹੈ ਅੱਜ ਸਵੇਰੇ ਸਵੇਰੇ ਹੀ ਮੀਂਹ ਪਿਆ ਸੀਗਾ ਅਤੇ ਕਾਫ਼ੀ ਜ਼ਿਆਦਾ ਮੌਸਮ ਹੁਣ ਧੁੱਪ ਵਾਲਾ ਵਧੀਆ ਲੱਗ ਰਿਹਾ ਸਾਰੇ ਧੁੱਪ ਨੂੰ ਇੰਜੋਏ ਕਰ ਰਹੇ ਨੇ ਅਤੇ ਕਾਫ਼ੀ ਜ਼ਿਆਦਾ ਪਟਿਆਲੇ ਦੇ ਵਿੱਚ ਤਾਂ ਮੌਸਮ ਹਰ ਰੁੱਤ ਆਪਣੇ ਸਮੇਂ ਅਨੁਸਾਰ ਆਉਂਦੀ ਨੇ ਅਤੇ ਜਾਂਦੀ ਹੈ ਆਪਣੇ ਨਾਲ ਖੁਸ਼ੀਆਂ ਤਿਉਹਾਰ ਲੈ ਕੇ ਆਉਂਦੀ ਹੈ ਜੀ ਧੰਨਵਾਦ